ਮੇਰਾ ਨਾਂ ਭਾਰਤ ਭੂਸ਼ਣ ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਦਾ ਅਤੇ ਖੇਤੀਬਾੜੀ ਦੇ ਹੁਨਰ ਦੀ ਕੀਤੀਆਂ ਨੂੰ ਜੇਕਰ ਹੋਰ ਕੰਮਾਂ ਬਾਰੇ ਪੁੱਛਿਆ ਜਾਵੇ ਅਤੇ ਉਹ ਖੇਤੀਬਾੜੀ ਤਾਂ ਸਾਰੇ ਹੀ ਕਰ ਲੈਂਦੇ ਆ ਖੇਤੀਬਾੜੀ ਦੇ ਵਿੱਚ ਉਹ ਕਾਫੀ ਮਿਹਨਤ ਕਰਦੇ ਆ ਮਿਹਨਤੀ ਹੋਣ ਦੇ ਨਾਲ ਨਾਲ ਹੁਨਰਬਾਜ਼ ਵੀ ਹੁੰਦੇ ਆ ਜਿਹਨਾਂ ਟਰੈਕਟਰ ਚਲਾਉਣਾ ਕਹੀ ਚਲਾਉਣੀ ਅਤੇ ਨਾਲ ਗੋਡੀ ਵਗੈਰਾ ਜੋ ਵੀ ਹੈ ਸਭ ਕਰ ਲੈਂਦੇ ਆ ਅਤੇ ਕਾਫੀ ਜ਼ਿਆਦਾ ਮਿਹਨਤੀ ਹੁੰਦੇ ਆ ਅਤੇ ਮਿਹਨਤੀ ਮਿਹਨਤੀ ਹੋਣ ਦੇ ਨਾਲ ਨਾਲ ਇੰਟੈਲੀਜੈਂਟ ਵੀ ਹੁੰਦੇ ਅੱਜ ਕੱਲ੍ਹ ਦੇ ਤੁਹਾਨੂੰ ਪਤਾ ਹੀ ਆ ਪੜ੍ਹੇ ਲਿਖੇ ਵੀ ਹੁੰਦੇ ਆ ਤੋਂ ਜ਼ਿਆਦਾਤਰ ਕਿਸਾਨ ਮਿਹਨਤ ਕਰਨਾ ਜ਼ਿਆਦਾ ਪਸੰਦ ਕਰਦੇ ਆ ਅਤੇ ਅਤੇ ਟਰੈਕਟਰ ਵਗੈਰਾ 'ਤੇ ਚਲਾ ਹੀ ਲੈਂਦੇ ਆ ਅਤੇ ਇਸ ਲਈ ਉਹ ਡਰਾਈਵਰੀ ਕਰਨਾ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਆ ਇਸੇ ਚੱਕਰ ਦੇ ਵਿੱਚ ਉਹ ਕਾਫੀ ਕਿਸਾਨ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਕਿਸਾਨੀ ਕਰਦੇ ਆ ਖੇਤੀਬਾੜੀ ਕਰਦੇ ਆ ਅਤੇ ਨਾਲ ਦੀ ਨਾਲ ਡਰਾਈਵਰੀ ਵੀ ਕਰਦੇ ਆ ਲੋਕਲ ਦੀ ਗੱਲ ਕੀਤੀ ਜਾਵੇ ਜਿੱਦਾਂ ਕਾਫੀ ਵੱਡੀਆਂ ਕੰਪਨੀਆਂ ਜਿੱਦਾਂ ਰੋਡ ਬਣਾਉਂਦੀਆਂ ਅਤੇ ਜਾਂ ਰੋਡ ਦੇ ਨਾਲ ਨਾਲ ਫਲਾਈ ਓਵਰਸ ਵਗੈਰਾ ਬਣਾਉਂਦੀਆਂ ਉਹਨਾਂ ਵਿੱਚ ਟਰੈਕਟਰ ਟਰਾਲੀਆਂ ਜੇ ਸੀ ਬੀਆਂ ਅਤੇ ਟਰੱਕ ਵਗੈਰਾ ਸਾਡੇ ਕਿਸਾਨ ਵੀਰ ਹੀ ਚਲਾਉਂਦੇ ਨੇ ਕਿਸਾਨ ਵੀਰ ਇਹਨਾਂ ਸਾਰੀਆਂ ਚੀਜ਼ਾਂ ਦੇ ਹੁਨਰਬਾਜ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਚਲਾਉਂਦੇ ਆ ਅਤੇ ਇਹਨਾਂ ਦੀ ਇਨਕਮ ਕਾਫੀ ਠੀਕ ਹੋ ਜਾਂਦੀ ਹੈ ਅਤੇ ਨਾਲ ਦੀ ਨਾਲ ਖੇਤੀਬਾੜੀ ਜ਼ਰੂਰ ਕਰਦੇ ਹਨ ਧੰਨਵਾਦ ਜੀ